ਮੇਰਾ ਜੱਦੀ ਸ਼ਹਿਰ ਪਟਿਆਲਾ ਹੈ ਪਟਿਆਲੇ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਹਨ ਪਰ ਖ਼ਾਸ ਚੀਜ਼ ਇੱਥੋਂ ਦਾ ਪੋਲੋ ਗਰਾਊਂਡ ਹੈ ਪੋਲੋ ਗਰਾਊਂਡ ਇੱਕ ਬਹੁਤ ਵੱਡਾ ਗਰਾਊਂਡ ਹੈ ਜਿਸ ਵਿੱਚ ਹਰੇਕ ਕਿਸਮ ਦੀ ਖੇਡ ਖੇਡੀ ਜਾ ਸਕਦੀ ਹੈ ਅਤੇ ਹਰੇਕ ਖੇਡ ਦੇ ਲਈ ਅਲੱਗ ਅਲੱਗ ਗਰਾਊਂਡ ਹਨ ਇਸ ਵਿੱਚ ਫੁੱਟਵਾਲ ਹਾਕੀ ਵਾਲੀਵਾਲ ਅਤੇ ਇਸ ਤੋਂ ਇਲਾਵਾ ਅੰਦਰ ਖੇਡੀਆਂ ਜਾਣ ਵਾਲੀਆਂ ਖੇਡਾਂ ਵੀ ਹਨ